ਹਾਂਜੀ ਜੇ ਜੋ ਇਹ ਰਿਲੇਅ ਦੌੜ ਹੈ ਮੈਂ ਇਸ ਦੌੜ ਦੇ ਵਿੱਚ ਲਗਭਗ ਆਪਣੇ ਸਕੂਲ ਤੋਂ ਲੈ ਕੇ ਆਪਣੇ ਕੋਲਜ ਤੱਕ ਦੀ ਪੜ੍ਹਾਈ ਉਸ ਤੋਂ ਬਾਅਦ ਯੂਨੀਵਰਸਿਟੀ ਦੇ ਵਿੱਚ ਜੋਬ ਉਹਦੇ ਵਿੱਚ ਜੋ ਐਥਲੈਟਿਕਸ ਮੀਟ ਹੁੰਦੀ ਸੀ ਉਸ ਰਿਲੇਅ ਦੌੜ ਦੇ ਵਿੱਚ ਮੈਂ ਹਿੱਸਾ ਲੈਂਦਾ ਹੁੰਦਾ ਸੀ ਜੋ ਕਿ ਮੈਂ ਸਕੂਲ ਟਾਈਮ ਤੋਂ ਹੀ ਸ਼ੁਰੂ ਕੀਤਾ ਸੀ ਸਕੂਲ ਟਾਈਮ ਦੇ ਵਿੱਚ ਜੋ ਸਾਡੇ ਡੀ ਪੀ ਮਾਸਟਰ ਜੀ ਹੁੰਦੇ ਸੀ ਉਹ ਉਹਨਾਂ ਨੇ ਸਾਨੂੰ ਹਮੇਸ਼ਾ ਇਹ ਗਾਈਡ ਕਰਨਾ ਕਿ ਤੁਸੀਂ ਆਪਣੇ ਸਿਹਤ ਨੂੰ ਕਿਵੇਂ ਫਿੱਟ ਰੱਖਣਾ ਫਿਜੀਕਲ ਟੀਚਰ ਜੋ ਹੁੰਦੇ ਸੀਗੇ ਤਾਂ ਉਹ ਸਕੂਲ ਦੇ ਵਿੱਚ ਜੋ ਇੰਟਰ ਸਕੂਲ ਹੈ ਨਾ ਅੰਤਰ ਸਕੂਲੀ ਜੋ ਟੂਰਨਾਮੈਂਟ ਹੁੰਦੇ ਸੀਗੇ ਮੈਚ ਹੁੰਦੇ ਸੀਗੇ ਉਹਨਾਂ ਦੇ ਵਿੱਚ ਜਦੋਂ ਅਸੀਂ ਹਿੱਸਾ ਲੈਂਦੇ ਸੀ ਤਾਂ ਉਹ ਰਿਲੇਅ ਦੌੜ ਦੇ ਵਿੱਚ ਵੀ ਅਸੀਂ ਹਿੱਸਾ ਲੈਂਦੇ ਸੀ ਤਾਂ ਉਹਦੇ ਵਿੱਚ ਅਨੁਭਵ ਇਹ ਹੁੰਦਾ ਸੀ ਕਿ ਮੈਂ ਹਮੇਸ਼ਾ ਸਟਾਰਟ ਸਟਾਰਟਿੰਗ ਪੁਆਇੰਟ 'ਤੇ ਹੁੰਦਾ ਸੀ ਸਟਾਰਟਿੰਗ ਪੁਆਇੰਟ ਤੋਂ ਭੱਜ ਕੇ ਫਿਰ ਨੈਕਸਟ ਜੋ ਆਪਣੀ ਟੀਮ ਦਾ ਮੈਂਬਰ ਹੁੰਦਾ ਸੀ ਉਸਨੂੰ ਰਿਲੋਅ ਰਿਲੇਅ ਦੌੜ ਦੇ ਵਿੱਚ ਜੋ ਵੀ ਸਾਨੂੰ ਫੜਾਇਆ ਜਾਂਦਾ ਸੀ ਉਹ ਭੱਜ ਕੇ ਉਸ ਅਗਲੇ ਮੈਂਬਰ ਨੂੰ ਅਸੀਂ ਦੇਣਾ ਹੁੰਦਾ ਸੀ ਹੁਣ ਫਿਰ ਆਪਾਂ ਨੂੰ ਅੱਗੋਂ ਭੱਜ ਕੇ ਆਪਣੇ ਨੈਕਸਟ ਜੋ ਸਾਡਾ ਟੀਮ ਦਾ ਮੈਂਬਰ ਹੁੰਦਾ ਸੀ ਉਹਨੂੰ ਉਹ ਦੇਣਾ ਹੁੰਦਾ ਸੀ ਤਾਂ ਉਸ ਦੌੜ ਦੇ ਵਿੱਚ ਬੜਾ ਇੱਕ ਇੱਕ ਇੱਕ ਟੀਮ ਵਰਕ ਹੋ ਜਾਂਦਾ ਕਿਉੰਕਿ ਦੌੜ ਜੋ ਹਮੇਸ਼ਾ ਹੁੰਦੀ ਉਹ ਹਮੇਸ਼ਾ ਇਕੱਲੇ ਬੰਦੇ ਦੀ ਹੁੰਦੀ ਹੈ ਚਾਹੇ ਉਹ ਤੁਸੀਂ ਟੂਰਨਾਮੈਂਟ 'ਚ ਲਾ ਲਓ ਜਾਂ ਪਰਸਨਲ ਲਾਈਫ ਦੇ ਵਿੱਚ ਲਾ ਲਓ ਲੇਕਿਨ ਰਿਲੇਅ ਦੌੜ ਇੱਕ ਐਸੀ ਦੌੜ ਹੈ ਕਿ ਜਿਹਦੇ ਵਿੱਚ ਤੁਹਾਡੀ ਇੱਕ ਟੀਮ ਵਰਕ ਹੋ ਜਾਂਦਾ ਤਾਂ ਉਸ ਦੇ ਵਿੱਚ ਤੁਹਾਡੇ ਟੀਮ ਮੈਂਬਰ ਜੋ ਹੈ ਕਿ ਬੜੇ ਅਨੁਭਵੀ ਅਤੇ ਐਕਟਿਵ ਹੋਣੇ ਚਾਹੀਦੇ ਹੈ ਕਿ ਜਿਸ ਨਾਲ ਤੁਸੀਂ ਜਿੱਤ ਸਕੋ ਜਿੱਤ ਜ਼ਰੂਰੀ ਨਹੀਂ ਹੈ ਹਰ ਇੱਕ ਟੂਰਨਾਮੈਂਟ ਦੇ ਵਿੱਚ ਹਾਂ ਲੇਕਿਨ ਜਿੱਤ ਦੀ ਜਿੱਤ ਨੂੰ ਅਸੀਂ ਮੱਦੇ ਨਜ਼ਰ ਰੱਖ ਕੇ ਹੀ ਟੂਰਨਾਮੈਂਟ ਦੇ ਵਿੱਚ ਹਿੱਸਾ ਲੈਂਦੇ ਹਾਂ ਜਿੱਤ ਬੜੀ ਜ਼ਰੂਰੀ ਵੀ ਹੈ

ਅਤੇ ਆਪਣੇ ਜੋ ਸਾਨੂੰ ਹੱਥ ਵਿੱਚ ਫੜਾਇਆ ਜਾਂਦਾ ਸੀ ਉਸਨੂੰ ਆਪਣੀ ਮੰਜ਼ਿਲ ਤੱਕ ਪਹੁੰਚਾਉਣਾ ਤਾਂ ਉੱਥੇ ਡੀ ਪੀ ਮਾਸਟਰ ਜੀ ਸਾਡੇ ਕੋਚ ਐਜ ਏ ਕੋਚ ਕੰਮ ਕਰਦੇ ਸੀਗੇ ਹੈ ਨਾ ਫਿਰ ਅਸੀਂ ਕੋਲਜ ਦੇ ਵਿੱਚ ਆਏ ਉੱਥੇ ਵੀ ਇੱਕ ਪੀ ਟੀ ਮਾਸਟਰ ਹੁੰਦੇ ਸੀ ਜਦੋਂ ਅਥਲੈਟਿਕ ਮੀਟ ਹੋਣੀ ਤਾਂ ਅਸੀਂ ਹਰ ਇੱਕ ਅਥਲੈਟਿਕ ਮੀਟ ਦੇ ਵਿੱਚ ਹਿੱਸਾ ਲੈਣਾ ਤਾਂ ਉਹਦੇ ਵਿੱਚ ਵੀ ਜੋ ਰਿਲੇਅ ਦੌੜ ਹੁੰਦੀ ਸੀ ਉਹਦੇ ਵਿੱਚ ਹਿੱਸਾ ਲੈਂਦੇ ਸੀ ਇੱਕ ਵਾਰ ਅਸੀਂ ਜਿੱਤੇ ਹਾਂ ਭਾਈ ਉਸ ਤੋਂ ਬਾਅਦ ਅਸੀਂ ਦੋ ਦੋ ਵਾਰ ਹਾਰੇ ਵੀ ਹੈ ਪਰ ਇੰਨਾ ਕਿ ਉਹਦੇ ਵਿੱਚ ਬੜਾ ਮਜ਼ਾ ਆਉਂਦਾ ਸੀ ਕਿ ਅਸੀਂ ਇੱਕ ਟੀਮ ਵਰਕ ਦੇ ਤੌਰ 'ਤੇ ਕੰਮ ਕਰ ਰਹੇ ਹਾਂ ਅਤੇ ਕੋਲਜ ਲਈ ਖੇਡ ਰਹੇ ਹਾਂ ਹੈ ਨਾ ਤਾਂ ਉਸ ਤੋਂ ਯੂਨੀਵਰਸਿਟੀ ਦੇ ਵਿੱਚ ਵੀ ਜਦੋਂ ਅਸੀਂ ਜੁਆਇਨ ਕੀਤਾ ਉਹਦੇ ਵਿੱਚ ਵੀ ਜੋ ਅਥਲੈਟਿਕ ਮੀਟ ਹੋਇਆ ਕਰਦੀ ਸੀ ਉਹਦੇ ਵਿੱਚ ਸਟੂਡੈਂਟ ਤਾਂ ਪਾਰਟੀਸਪੇਟ ਕਰਦੇ ਹੀ ਕਰਦੇ ਸੀ ਹਿੱਸਾ ਲੈਂਦੇ ਸੀ ਲੇਕਿਨ ਉਸ ਤੋਂ ਇਲਾਵਾ ਸਟਾਫ ਮੈਂਬਰ ਵੀ ਉਹਦੇ ਵਿੱਚ ਹਿੱਸਾ ਲੈਂਦੇ ਸੀ ਲਾਈਕ ਟੀਚਿੰਗ ਸਟਾਫ ਜਾਂ ਨੋਨ ਟੀਚਿੰਗ ਸਟਾਫ ਹੈ ਨਾ ਅਤੇ ਉੱਥੇ ਵੀ ਫਿਜੀਕਲ ਟੀਚਰ ਜੋ ਹੁੰਦੇ ਹੈ ਫਿਜੀਕਲ ਐਜੂਕੇਸ਼ਨ ਦੇ ਟੀਚਰ ਉਹ ਵੀ ਐਜ ਏ ਕੋਚ ਕੰਮ ਕਰਦੇ ਹੈ ਲੇਕਿਨ ਜੇ ਮੈਂ ਸੋਚਿਆ ਕਿ ਮੈਂ ਇੱਕ ਅਲੱਗ ਤੋਂ ਪਰਸਨਲ ਆਪਣੇ ਤੌਰ 'ਤੇ ਇੰਡਵਿਜੁਅਲ ਰਿਲੇਅ ਦੌੜ ਦੇ ਵਿੱਚ ਮੇਰਾ ਕੋਈ ਕੋਚ ਨਹੀਂ ਰਿਹਾ ਹਾਂ ਸਕੂਲ ਟਾਈਮ ਕੋਲਜ ਟਾਈਮ ਯੂਨੀਵਰਸਿਟੀ ਟਾਈਮ ਜੋ ਪੀ ਟੀ ਮਾਸਟਰ ਹੁੰਦੇ ਸੀ ਉਹ ਸਾਡੇ ਕੋਚ ਜਾਂ ਸਲਾਹਕਾਰ ਹੁੰਦੇ ਸੀ ਅਤੇ ਬੜਾ ਅੱਛਾ ਅਨੁਭਵ ਸਾਨੂੰ ਹੁੰਦਾ ਸੀ ਉਸ ਉਸ ਸਮੇਂ ਦੇ ਵਿੱਚ